ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਔਰਤਾਂ ਅਤੇ ਪੇਂਡੂ ਖੇਤਰਾਂ ਲਈ ਮੌਕੇ ਬਰਾਬਰ ਹਨ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਪੇਂਡੂ ਖੇਤਰ ਦੀਆਂ ਰੂਲਰ ਸੀਟਾਂ ਅੱਜ ਕੱਲ੍ਹ ਹਰੇਕ ਕੋਲਜ ਦੇ ਵਿੱਚ ਆਪਾਂ ਨੂੰ ਦੱਸੀਆਂ ਜਾਂਦੀਆਂ ਹਨ ਵੀ ਇੰਨੀਆਂ ਸੀਟਾਂ ਰੂਲਰ ਏਰੀਏ ਲਈ ਹਨ ਇੰਨੀਆਂ ਫੀਮੇਲ ਲਈ ਹਨ ਅੱਜ ਕੱਲ੍ਹ ਆਪਾਂ ਆਈਆਈਟੀਜ਼ ਦੇ ਵਿੱਚ ਵੇਖ ਲਈਏ ਕਿ ਲੇਡੀਜ਼ ਦੀਆਂ ਜਿਹੜੀਆਂ ਹੈਗੀਆਂ ਫੀਮੇਲ ਦੇ ਕੈਂਡੀਡੇਟ ਦੀਆਂ ਸੀਟਾਂ ਜਿਹੜੀਆ ਹੈਗੀਆਂ ਉਹ ਰਿਜ਼ਰਵ ਕਰ ਦਿੱਤੀਆਂ ਗਈਆਂ ਹਨ ਅਤੇ ਇਕਨੋਮੀਕਲੀ ਬੈਕਵਰਡ ਅਤੇ ਹੋਰ ਰੂਲਰ ਬੈਕਵਰਡ ਦੇ ਜਿਹੜੇ ਬੱਚੇ ਹਨ ਉਹਨਾਂ ਨੂੰ ਬਕਾਇਦਾ ਕੋਟੇ ਦਿੱਤੇ ਗਏ ਹਨ ਉਨ੍ਹਾਂ ਦੀ ਉਸੇ ਦੇ ਅਕੋਡਿੰਗਲੀ ਜਿਹੜੀ ਹੈਗੀ ਹੈ ਆਪਣੀ ਜਿਹੜੀ ਹੈਗੀ ਹੈ ਭਰਤੀ ਜਿਹੜੀ ਹੈਗੀ ਹੈ ਉਹ ਹੁੰਦੀ ਹੈਗੀ ਹੈ ਅੱਜ ਕੱਲ੍ਹ ਅਸੀਂ ਨਹੀਂ ਵੇ ਦੇਖਦੇ ਕਿ ਕਿਸੇ ਨਾਲ ਕੋਈ ਅਨਿਆਏ ਹੋ ਰਿਹਾ ਹੈਗਾ ਇਸ ਕਰਕੇ ਹਰੇਕ ਨੂੰ ਔਰਤਾਂ ਨੂੰ ਪੇਂਡੂ ਖੇਤਰ ਨੂੰ ਅਤੇ ਜੇਕਰ ਆਪਾਂ ਰਿਜ਼ਰਵੇਸ਼ਨ ਵਾਲੇ ਪਾਸੇ ਵਾਲੀ ਤਾਂ ਹਰੇਕ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਂਦਾ ਹੈ ਜਿਸ ਵਿੱਚ ਉਹਦਾ ਹੱਕ ਬਣਦਾ ਉਹਨੂੰ ਉਸ ਦੇ ਹੱਕ ਵਿੱਚ ਉਹਦਾ ਹੱਕ ਮਿਲਦਾ ਹੈ ਥੈਂਕ ਯੂ